ਇੱਕ ਵਾਰ ਮੈਂ ਨਾ ਐਮਾਜੋਨ ਤੋਂ ਲੈਪਟੋਪ ਬੁੱਕ ਕੀਤਾ ਸੀਗਾ ਉਹ ਲੈਪਟੋਪ ਦਾ ਜਿਹੜਾ ਨਾਮ ਸੀ ਲੀਨੋਵੋ ਕੰਪਨੀ ਦਾ ਮੈਂ ਉਹ ਲੈਪਟੋਪ ਬੁੱਕ ਕੀਤਾ ਸੀ ਅਤੇ ਜਦੋਂ ਮੈਂ ਉਹਨੂੰ ਔਨਲਾਈਨ ਦੇਖਿਆ ਸੀ ਤਾਂ ਉਹਦਾ ਜਿਹੜਾ ਰੇਟ ਸੀ ਲਗਭਗ ਤੀਹ ਹਜ਼ਾਰ ਸਮਥਿੰਗ ਸੀ ਅਤੇ ਤੀਹ ਉਨੇ ਦਾ ਹੀ ਮੈਨੂੰ ਮਿਲਿਆ ਪਰ ਜਦੋਂ ਮੈਂ ਉਹਨੂੰ ਔਨਲਾਈਨ ਦੇਖਿਆ ਸੀ ਉਹਦੀ ਜਿਹੜੀ ਫੋਟੋਆਂ ਪਈਆਂ ਸੀਗੀਆਂ ਉਹਦੇ ਪਰ ਐਮਾਜੋਨ 'ਤੇ ਉਹ ਉਹਦੀ ਸਕਰੀਨ ਬਹੁਤ ਸੋਹਣੀ ਸੀ ਉਹਦੇ ਜਦੋਂ ਮਤਲਬ ਬਹੁਤ ਵਧੀਆ ਐਕਸੈਸਰੀ ਸਾਰਾ ਕੁਛ ਵਧੀਆ ਸੀ ਰੈਮ ਵੀ ਬਹੁਤ ਅਡਵਾਂਸ ਰੈਮ ਸੀ ਸਾਰਾ ਕੁਛ ਵਧੀਆ ਸੀਗਾ ਅਤੇ ਵਿੰਡੋ ਵੀ ਬਹੁਤ ਵਧੀਆ ਉਹਦੇ ਵਿੱਚ ਦੱਸੀ ਹੋਈ ਸੀ ਐਕਸੈਸਰੀ ਬਹੁਤ ਸੋਹਣੀ ਦੱਸੀ ਸੀ ਚਾਰਜਰ ਸਾਰਾ ਕੁਛ ਅਵੇਲੇਬਲ ਸੀਗਾ ਪਰ ਜਦੋਂ ਮੈਂ ਔਡਰ ਕਰਕੇ ਉਹ ਮੰਗਵਾਈ ਇੱਕ ਤਾਂ ਔਨਲਾਈਨ ਮੈਂ ਪੇਮੈਂਟ ਵੀ ਕੀਤੀ ਜਦੋਂ ਮੇਰੇ ਕੋਲ ਘਰ ਆਇਆ ਉਹ ਬੋਕਸ ਦੇ ਵਿੱਚ ਤਾਂ ਜਦੋਂ ਮੈਂ ਉਹਨੂੰ ਕੱਢਿਆ ਤਾਂ ਜਿਹੜੀ ਉਹਦੀ ਸਕਰੀਨ ਸੀਗੀ ਪਹਿਲਾਂ ਤਾਂ ਮੈਂ ਉਹ ਲੈਪਟੋਪ ਦੇਖ ਕੇ ਉਹਨੂੰ ਹੈਰਾਨ ਹੋ ਗਿਆ ਵੀ ਇਹ ਉਹੀ ਲੈਪਟੋਪ ਆ ਜਿਹੜਾ ਮੈਂ ਔਡਰ ਕੀਤਾ ਸੀ ਪਰ ਜਦੋਂ ਮੈਂ ਉਹਨੂੰ ਨਾਲ ਦੀ ਨਾਲ ਉਹਨੂੰ ਮੈਂ ਦੇਖਿਆ ਫਿਰ ਕਿਉਂਕਿ ਇਹ ਉਹਦੀ ਜਿਹੜੀ ਸਕਰੀਨ ਸੀਗੀ ਉਹਦੇ ਪਰ ਸਕਰੈਚ ਬਹੁਤ ਪਏ ਹੋਏ ਸੀਗੇ ਅਤੇ ਈਵਨ ਕਿ ਜਿਹੜੇ ਉਹਦੇ ਸਵਿੱਚ ਹੁੰਦੇ ਆ ਆਪਣੇ ਕੀਬਰਡ ਜਿਹੇ ਆ ਹੈਗੇ ਆ ਅਤੇ ਉਹਦੇ ਵਿੱਚ ਵੀ ਜਿੱਦਾਂ ਦਾ ਕੁਛ ਡਸਟ ਜਿੱਦਾਂ ਫਸੀ ਹੁੰਦੀ ਆ ਤੁਸੀਂ ਕਹਿ ਲਓ ਵੀ ਧੂੜ ਮਿੱਟੀ ਹੈ ਲੱਗਦਾ ਸੀਗਾ ਦੇਖਣ ਨੂੰ ਵੀ ਜਿੱਦਾਂ ਉਹ ਪਹਿਲਾਂ ਵਰਤਿਆ ਹੁੰਦਾ ਅਤੇ ਮੈਂ ਹੈਰਾਨ ਰਹਿ ਗਿਆ ਜਦੋਂ ਮੈਂ ਉਹਦਾ ਚਾਰਜਰ ਦੇਖਿਆ ਕੱਢ ਕੇ ਤਾਂ ਜਿਹੜਾ ਚਾਰਜ ਦਾ ਜਿਹੜਾ ਪਿੰਨ ਹੁੰਦੀ ਆ ਉਹਦੀ ਮਤਲਬ ਪਿੰਨ ਵੀ ਸਿੱਧੀ ਨਹੀਂ ਸੀਗੀ ਮੁੜੀ ਹੋਈ ਸੀ ਜਿਵੇਂ ਕਿ ਨਾ ਕਿਸੇ ਨੇ ਉਹਦੇ ਨਾਲ ਸ਼ਰਾਰਤ ਕੀਤੀ ਹੁੰਦੀ ਉਹਨੂੰ ਪਲੱਗ ਦੇ ਵਿੱਚ ਫਸਾ ਕੇ ਘੁਮਾ ਦਿੱਤਾ ਗਿਆ ਹੁੰਦਾ ਤਾਂ ਮੈਂ ਉਹ ਹੈਰਾਨ ਹੋ ਗਿਆ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਇੱਦਾਂ ਦਾ ਮੇਰਾ ਐਕਸਪੀਰੀਅੰਸ ਪਹਿਲਾਂ ਨਹੀਂ ਹੋਇਆ ਸੀ ਵੀ ਇੰਨਾ ਖ਼ਰਾਬ ਮੈਂ ਜਿਹੜਾ ਲੈਪਟੋਪ ਜੋ ਮੰਗਵਾਇਆ ਸੀਗਾ ਆਪਣੇ ਆਪਣੀ ਆਪਣੇ ਲੈਵਲ 'ਤੇ ਮੈਂ ਇਹ ਸੋਚ ਕੇ ਮੰਗਵਾਇਆ ਸੀਗਾ ਵੀ ਮੈਨੂੰ ਇੱਕ ਵਧੀਆ ਲੈਪਟੋਪ ਮਿਲਣ ਲੱਗਿਆ ਹੈ ਆ ਕਿਉਂਕਿ ਉਹ ਜਿਹੜਾ ਲੈਪਟੋਪ ਸੀ ਉਸ ਤੋਂ ਦਸ ਦਿਨ ਪਹਿਲਾਂ ਉਹ ਲਗਭਗ ਸੈਂਤੀ ਹਜ਼ਾਰ ਦਾ ਸੀ ਪਰ ਦਿਵਾਲੀ ਔਫਰ ਕਰਕੇ ਉਹਦੇ ਪਰ ਤੀਹ ਹਜ਼ਾਰ ਦਾ ਲੱਗਿਆ ਸੀਗਾ ਮੈਂ ਆਪਣੀ ਖੁਸ਼ੀ ਖੁਸ਼ੀ ਮੰਗਵਾਇਆ ਵੀ ਦਿਵਾਲੀ ਦੇ ਔਫਰ 'ਤੇ ਮੈਂ ਇਹ ਮੰਗਵਾਇਆ ਪਰ ਜਦੋਂ ਉਹਨੂੰ ਕੱਢਿਆ ਤਾਂ ਉਹ ਜਮ੍ਹਾ ਹੀ ਰੱਦੀ ਮਾਲ ਨਿਕਲਿਆ ਮੈਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਆਇਆ ਅਤੇ ਮੈਂ ਮੁੜ ਕੇ ਐਮਾਜੋਨ 'ਤੇ ਉਹਦੀ ਜਿਹੜੀ ਮੈਂ ਔਨਲਾਈਨ ਸ਼ੋਪਿੰਗ ਵੀ ਨਹੀਂ ਕੀਤੀ ਮੈਂ ਐਨਾਜੋਨ ਨੂੰ ਕੋਲ ਵੀ ਕੀਤੀ ਜਿਹੜਾ ਉਹਨਾਂ ਦਾ ਸਰਵਿਸ ਸੈਂਟਰ ਸੀਗਾ ਉਹਨਾਂ ਨੂੰ ਦੱਸਿਆ ਪਰ ਉਹ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਉਹਨਾਂ ਨੇ ਉਹ ਕਹਿੰਦੇ ਜੀ ਹੁਣ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਅਤੇ ਤੁਸੀਂ ਜਦੋਂ ਲਿਆ ਸੀਗਾ ਉਹਨੂੰ ਹੀ ਉੱਦੋਂ ਹੀ ਓਪਨ ਕਰਕੇ ਉਹ ਬੰਦੇ ਨੂੰ ਕਹਿੰਦੇ ਤਾਂ ਹੁਣ ਕਿੱਦਾਂ ਕਹਿੰਦੇ ਮੈਂ ਤਾਂ ਉੱਦੋਂ ਘਰੇ ਵੀ ਨਹੀਂ ਸੀਗਾ ਮੈਂ ਕਿਤੇ ਬਾਹਰ ਗਿਓ ਸੀਗਾ ਪਿੱਛੇ ਤੋਂ ਘਰਦਿਆਂ ਨੇ ਉਹਨੂੰ ਰਿਸੀਵ ਕੀਤਾ ਘਰਦਿਆਂ ਨੂੰ ਪਤਾ ਵੀ ਨਹੀਂ ਸੀ ਕਿ ਮੈਂ ਇਹ ਲੈਪਟੋਪ ਔਨਲਾਈਨ ਮੰਗਵਾ ਰਿਹਾ ਹਾਂ ਕਿਉਂਕਿ ਮੈਂ ਦਿਵਾਲੀ ਗਿਫ਼ਟ ਦੇਣਾ ਸੀਗਾ ਘਰਦਿਆਂ ਨੂੰ ਅਤੇ ਕਿਉਂਕਿ ਅਸੀਂ ਮੇਰੇ ਬੱਚਾ ਵੀ ਬੇਟਾ ਵੀ ਹੈਗਾ ਸੀ ਰਲ ਕੇ ਸਾਰਿਆਂ ਨੇ ਇਹ ਲੈਪਟੋਪ ਯੂਜ਼ ਕਰਨਾ ਸੀ ਇਹ ਸਾਰਾ ਜਿਹੜਾ ਮੇਰਾ ਐਕਸਪੀਰੀਅੰਸ ਬਹੁਤ ਹੀ ਖ਼ਰਾਬ ਰਿਹਾ ਮੈਂ ਮੁੜ ਕੇ ਐਮਾਜੋਨ ਤੋਂ ਜੋ ਖਰੀਦਦਾਰੀ ਬੰਦ ਕਰਤੀ ਕਰਨੀ